ਹਾਂਜੀ ਮੈਂ ਫੋਨ ਕੀਤਾ ਸੀਗਾ ਕਿ ਮੈਂ ਪਿੱਛੇ ਇੱਕ ਕੈਬ ਬੁੱਕ ਕਰਵਾਈ ਸੀਗੀ ਲੇਕਿਨ ਮੈਨੂੰ ਕਿਸੇ ਖ਼ਾਸ ਵਜ੍ਹਾ ਕਰਕੇ ਉਹਨੂੰ ਰੱਦ ਕਰਨਾ ਪਿਆ ਸੀ ਟਰਿੱਪ ਅਤੇ ਮੇਰਾ ਡਿਫੈਂਡ ਇੱਕ ਡਿਊ ਹੈਗਾ ਅਤੇ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਸੀ ਕਿ ਰਿਫੰਡ ਕਦੋਂ ਤੱਕ ਮਿਲ ਸਕਦਾ ਹੈ ਅਤੇ ਅ ਦੂਸਰੀ ਚੀਜ਼ ਇਹ ਸੀਗੀ ਕਿ ਮੈਂ ਹੁਣ ਕਿਤੇ ਅ ਮੈਨੂੰ ਐਮਰਜੈਂਸੀ ਮੈਂ ਜਾਣਾ ਵੀ ਸੀਗਾ ਲੇਕਿਨ ਮੇਰੇ ਕੋਲ ਥੋੜ੍ਹਾ ਕੈਸ਼ ਦਾ ਪ੍ਰੋਬਲਮ ਹੋ ਰਿਹਾ ਅ ਮਤਲਬ ਪੈਸੇ ਨਹੀਂ ਹੈਗੇ ਮੇਰੇ ਕੋਲ ਫੰਡ 'ਚ ਅਤੇ ਜੇ ਹੋ ਸਕੇ ਤਾਂ ਜਿਹੜਾ ਤੁਸੀਂ ਰਿਫੰਡ ਅਗਰ ਟਾਈਮ ਸਿਰ ਨਹੀਂ ਆਉਣਾ ਤਾਂ ਮੈਨੂੰ ਉਹਨੂੰ ਉਹਦੀ ਐਡਜਸਟਮੈਂਟ ਦੇ ਦਿੱਤੀ ਜਾਵੇ ਅਤੇ ਅੱਛਾ ਜਿਹੜੀ ਐਡਜਸਟਮੈਂਟ ਦੇ ਸਕਦੇ ਚਲੋ ਬੜੀ ਮਿਹਰਬਾਨੀ ਕਿਉਂਕਿ ਹੁਣ ਮੈਂ ਇੱਥੋਂ ਇਸਕੋਨ ਟੈਂਪਲ ਕੋਲ ਇਸ ਵਕਤ ਹੈਗਾ ਹੈ ਔਰ ਮੈਂ ਇੰਡੀਆ ਗੇਟ ਜਾਣਾ ਹੈ ਕਿਸੇ ਕੰਮ ਲਈ ਅਤੇ ਜੇ ਹਾਂ ਉਹਦੇ ਵਿੱਚ ਐਡਜਸਟ ਹੋ ਜਾਏਗਾ ਠੀਕ ਹੈ ਫਿਰ ਤੁਸੀਂ ਮੇਰੀ ਬੁੱਕ ਕਰ ਦਿਓ ਮੈਨੂੰ ਭੇਜ ਦਿਓ ਜਲਦੀ ਡਰਾਈਵਰ ਤਾਂ ਕਿ ਮੈਂ ਆਪਣਾ ਇੱਕ ਤਾਂ ਐਡਜਸਟਮੈਂਟ ਹੋ ਜਾਏਗੀ ਇੱਕ ਤਾਂ ਮੇਰਾ ਹੁਣ ਜਿਹੜਾ ਜਾਣ ਦਾ ਸਫ਼ਰ ਵੀ ਹੋ ਜਾਏਗਾ ਥੈਂਕ ਯੂ